ਜੂਨ ਜੁਲਾਈ ਦੇ ਮਹੀਨੇ ਵਿੱਚ ਜੀਰੀ ਲਗਾਈ ਜਾਂਦੀ ਹੈ ਜੀਰੀ ਲਗਾਉਣ ਤੋਂ ਪਹਿਲਾਂ ਖੇਤਾਂ ਨੂੰ ਪਾਣੀ ਲਗਾਇਆ ਜਾਂਦਾ ਹੈ ਅਤੇ ਫਿਰ ਉਸ ਵਿੱਚ ਕੱਦੂ ਕੀਤਾ ਜਾਂਦਾ ਹੈ ਕੱਦੂ ਹੋ ਜਾਣ ਤੋਂ ਬਾਅਦ ਫਿਰ ਉਹਦੇ ਵਿੱਚ ਜੀਰੀ ਲਗਾਈ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਉਸ ਵਿੱਚ ਫੁੱਲ ਜਾਂ ਫਲ ਲੱਗ ਜਾਂਦੇ ਹਨ ਫਿਰ ਉਸਨੂੰ ਤਿੰਨ ਉਸ ਨੂੰ ਪਾਣੀ ਨਹੀਂ ਦਿੰਦੇ ਉਸ ਨੂੰ ਤਿੰਨ ਚਾਰ ਪਾਣੀ ਦੇਣ ਤੋਂ ਬਾਅਦ ਜਦੋਂ ਉਸ ਫਸਲ ਪੱਕ ਜਾਂਦੀ ਹੈ ਤਾਂ ਉਸਨੂੰ ਪਾਣੀ ਨਹੀਂ ਦਿੰਦੇ ਕਿਉਂਕਿ ਉਸਦੇ ਡਿੱਗਣ ਦਾ ਡਰ ਲੱਗਾ ਰਹਿੰਦਾ ਹੈ ਨਵੰਬਰ ਅਤੇ ਅਕਤੂਬਰ ਦੇ ਮਹੀਨੇ ਵਿੱਚ ਕਣਕ ਲਗਾਈ ਜਾਂਦੀ ਹੈ ਇਸ ਦੀ ਵਾਢੀ ਹੱਥਾਂ ਅਤੇ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਅਕਤੂਬਰ ਨਵੰਬਰ ਮਹੀਨੇ ਵਿੱਚ ਆਲੂ ਵੀ ਲਗਾਏ ਜਾਂਦੇ ਹਨ ਅਤੇ ਕਣਕ ਲੱਗਣ ਤੋਂ ਪ ਬਾਅਦ ਉਗਾਏ ਜਾਂਦੇ ਹਨ ਮਾਰਚ ਮਈ ਜੂਨ ਮਹੀਨੇ ਵਿੱਚ ਸੂਰਜਮੁਖੀ ਦੀ ਫਸਲ ਉਗਾਈ ਜਾਂਦੀ ਹੈ ਇਸ ਤੋਂ ਸਾਨੂੰ ਤੇਲ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਸੂਰਜਮੁਖੀ ਦੇ ਖੇਤ ਦੇ ਕੋਲ ਦੀ ਲੰਘਦੇ ਹਾਂ ਤਾਂ ਬਹੁਤ ਠੰਡਕ ਮਿਲਦੀ ਹੈ ਮਹਿਸੂਸ ਹੁੰਦੀ ਹੈ ਮਾਰਚ ਮਹੀਨੇ ਵਿੱਚ ਲਗਾਈ ਜਾਂਦੀ ਹੈ ਇਹ ਫਸਲ ਦੀ ਵਰਤੋਂ ਕਰਕੇ ਅਸੀਂ ਆਪਣੇ ਲਈ ਮੱਕੀ ਦਾ ਆਟਾ ਬਣਾਉਂਦੇ ਹਾਂ ਪਰ ਅੱਜ ਕੱਲ੍ਹ ਦੇ ਕਿਸਾਨ ਪਸ਼ੂਆਂ ਲਈ ਕੱਚੀ ਮੱਕੀ ਦਾ ਅਚਾਰ ਪਾਉਂਦੇ ਹਨ ਜੋ ਪਸ਼ੂ ਬਹੁਤ ਖਾਂਦੇ ਹਨ